ਹਾਂ ਮੇਰੇ ਕੋਲ਼ ਇੱਕ ਮਨਪੰਸਦ ਕਿਤਾਬ ਹੈ ਸੁਖਮਨੀ ਸਾਹਿਬ ਦਾ ਗੁਟਕਾ ਹੈ ਉਹ ਮੈਂ ਉਸ ਨੂੰ ਵਾਰ ਵਾਰ ਪੜ੍ਹਦੀ ਹਾਂ ਉਸ ਨੂੰ ਪੜ੍ਹਨ ਨਾਲ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਮੈਂ ਇਸ 'ਤੇ ਇੱਕ ਫਿਲਮ ਵੀ ਦੇਖਣਾ ਚਾਹਵਾਂਗੀ